ਸਕੂਲ ਆਮ ਤੌਰ 'ਤੇ ਹੈਂਡਸ ਔਨ ਪ੍ਰੋਜੈਕਟ ਪ੍ਰਦਰਸ਼ਨਾਂ ਅਤੇ ਢਾਂਚਾਗਤ ਡੈਮੋਸਟਰੇਸ਼ਨ ਤਰੀਕੇ ਨਾਲ ਸਟੱਕਚਰਡ ਕਲਾ ਸਿਖਾਉਂਦੇ ਹਨ ਵਿਦਿਆਰਥੀ ਵੱਖ ਵੱਖ ਕਲਾਤਮਕ ਮਾਧਿਅਮਾਂ ਦੀ ਪੜਚੋਲ ਕਰਦੇ ਨੇ ਜਿਵੇਂ ਕਿ ਪੇਂਟਿੰਗ ਡਰਾਇੰਗ ਮੂਰਤੀ ਅਤੇ ਸ਼ਿਲਪਕਾਰੀ ਅਧਿਆਪਕ ਜ਼ਿਆਦਾਤਰ ਤਕਨੀਕੀ ਹੁਨਰ ਅਤੇ ਰਚਨਾਤਮਕ ਸਮੀਕਰਨ ਦੋਵਾਂ 'ਤੇ ਜੋਰ ਦਿੰਦੇ ਨੇ ਪ੍ਰੋਜੈਕਟ ਕਲਾ ਦੀ ਸੰਪੂਰਨ ਉਤਸ਼ਾਹਿਤ ਕਰਦੇ ਹੋਏ ਖਾਸ ਥੀਮਾਂ ਜਾਂ ਇਤਿਹਾਸਿਕ ਸਮੇਂ ਦੇ ਨਾਲ ਇੱਕ ਸਾਰ ਹੋ ਸਕਦੇ ਹੈ ਟੀਮ ਵਰਕ ਨੂੰ ਉਤਸ਼ਾਹਿਤ ਕਰਦੇ ਕਰਕੇ ਵੀ ਬੱਚਿਆਂ ਦੀ ਰੁਚੀ ਵਿੱਚ ਵਾਧਾ ਹੁੰਦਾ ਹੈ ਕੁੱਲ ਮਿਲਾ ਕੇ ਅਸਲ ਟੀਚਾ ਕਲਾਤਮਕ ਹੁਨਰਾਂ ਦਾ ਪਾਲਣ ਪੋਸ਼ਣ ਕਰਨਾ ਰਚਨਾ ਨੂੰ ਉਤਸ਼ਾਹਿਤ ਕਰਨਾ ਅਤੇ ਉਹਨਾਂ ਦੇ ਛੋਟੀਆਂ ਛੋਟੀਆਂ ਕਲਾਵਾਂ ਦੀ ਪ੍ਰਸ਼ੰਸਾ ਕਰਨਾ ਹੁੰਦਾ ਹੈ

ਲੀਰਾਂ ਨੂੰ ਗੋਲਕਾਰ ਕਰ ਖਿੱਦੋ ਬਣਾਉਣੀ ਅਤੇ ਬਾਂਦਰ ਕਿੱਲਾ ਖੇਡਣਾ ਉਸਦਾ ਤਾਂ ਆਪਣਾ ਹੀ ਸਵਾਦ ਸੀ ਅੱਜ ਕੱਲ੍ਹ ਦੀਆਂ ਖੇਡਾਂ ਨਾਲੋਂ ਉਹ ਖੇਡਾਂ ਕਿਤੇ ਅਨੋਖੀਆਂ ਸਨ ਅਤੇ ਨਾਲ ਨਾਲ ਕਈ ਤਰ੍ਹਾਂ ਦੀਆਂ ਹੁਨਰ ਅਤੇ ਸ਼ਿਲਪਕਾਰੀਆਂ ਵੀ ਸਿਖਾਉਂਦੀਆਂ ਸਨ